ਹਾਂਜੀ ਸੁਦਾ ਕੀ ਹਾਲ ਨੇ ਮੈਂ ਗੁਰਸਿਮਰਨ ਗੱਲ ਕਰ ਰਹੀ ਹਾਂ ਹਾਂਜੀ ਹਾਂਜੀ ਹਾਂਜੀ ਬਸ ਬਸ ਮੈਂ ਤੁਹਾਡੇ ਨਾਲ ਗੱਲ ਇਸੇ ਲਈ ਕੀਤੀ ਹੈ ਕਿ ਮੈਂ ਨਾ ਬੁਟੀਕ ਦਾ ਕੰਮ ਕਰਨ ਨੂੰ ਸੋਚਦੀ ਹੈ ਕਿ ਆਪਣਾ ਨਵਾਂ ਕੁਛ ਸੈਟਅਪ ਕਰੀਏ ਅਤੇ ਜਿਸ ਤਰ੍ਹਾਂ ਆਪਾਂ ਦੋਨਾਂ ਦੇ ਫੈਸ਼ਨ ਡਿਜ਼ਾਇਨਿੰਗ ਕੀਤੀ ਹੈ ਅਤੇ ਅਗਰ ਤੁਸੀਂ ਇੰਟਰਸਟਿਡ ਹੈਗੇ ਹੋ ਅਤੇ ਆਪਾਂ ਥੋੜ੍ਹਾ ਜਿਹਾ ਕੰਮ ਸ਼ੁਰੂ ਕਰੀਏ ਜਾਂ ਹੋਰ ਵੀ ਓਪਸ਼ਨਸ ਹੈਗੀਆਂ ਕਿ ਜਿਸ ਤਰ੍ਹਾਂ ਆਪਾਂ ਕਿਸੇ ਵੱਡੀ ਇੰਡਸਟਰੀ ਦੇ ਵਿੱਚ ਜਾ ਕੇ ਜੋਬ ਲਈ ਵੀ ਅਪਲਾਈ ਕਰ ਸਕਦੇ ਹਾਂ ਤੁਸੀਂ ਮੈਨੂੰ ਕਹਿ ਰਹੇ ਇਹ ਨਾ ਕਿ ਵੀ ਮੈਂ ਮੈਂ ਕੁਛ ਸਟਾਰਟ ਅਪ ਕਰਨਾ ਚਾਹੁੰਦਾ

ਫਿਲਹਾਲ ਤਾਂ ਮੈਂ ਫਰੀ ਸੀ ਹਾਂ ਫਿਲਹਾਲ ਤਾਂ ਮੈਂ ਫਰੀ ਸੀ ਅ ਮੈਂ ਨਵਾਂ ਹੀ ਸਟਾਟਰ ਸਟਾਰਟ ਅਪ ਕਰਨ ਨੂੰ ਸੋਚਣ ਡਈ ਅਗਰ ਤੁਹਾਡੇ ਕੋਲ ਕੁਛ ਹੈ ਐਸਾ ਮੈਂ ਮਾਇੰਡ ਮੇਕ ਹੀ ਹੈ ਅਤੇ ਮੈਂ ਤੁਹਾਡੇ ਦੇ ਨਾਲ ਕਲੈਬਰੇਟ ਕਰ ਲਵਾਂਗੀ ਦੇਖ ਲੈਂਦੇ ਹਾਂ ਮੈਂ ਤੁਹਾਨੂੰ ਮਿਲ ਲੈਂਦੀ ਹਾਂ ਅਤੇ ਸਲਾਹ ਕਰ ਲੈਂਦੇ ਹਾਂ ਹੈ ਨਾ ਹਾਂ ਮੈਂ ਕਰ ਲਈ ਕਰ ਲਈ ਮੈਂ ਮਾਸਟਰ ਹਾਂ

ਠੀਕ ਹੈ ਮੈਂ ਫਿਰ ਕੱਲ੍ਹ ਨੂੰ ਮਿਲਦੀ ਤੁਹਾਨੂੰ ਹੈ ਨਾ

ਠੀਕ ਮੈਂ ਕਾਲ ਕਰਾਂਗੀ ਓਕੇ